ਪੰਜਾਬ ਵਿੱਚ ਉੱਚੇ ਕਾਰਖਾਨੇ ਵਿੱਚ ਕੰਮ ਕਰਨ ਵਾਲੇ ਵਰਕਰਾਂ ਨੂੰ ਹਰੇਕ ਕਾਰਖਾਨੇ ਵਿੱਚ ਖਤਰਾ ਹੀ ਹੁੰਦਾ ਹੈ ਜਿਵੇਂ ਕਿ ਫੈਕਟਰੀਆਂ 'ਚ ਕੰਮ ਕਰਦੇ ਆ ਫਿਰ ਪਟਾਕੇ ਬਣਾਉਂਦੇ ਆ ਉੱਥੇ ਵੀ ਜਾਨ ਨੂੰ ਖਤਰਾ ਹੁੰਦਾ ਲੇਬਰ ਲੇਬਰਾਂ ਨੂੰ ਪੂਰੀ ਜ ਖਤਰਾ ਹੁੰਦਾ ਜਿਵੇਂ ਬਿਜਲੀ ਘਰ 'ਚ ਬਿ ਲੱਗੇ ਹੁੰਦੇ ਆ ਬਿਜਲੀ 'ਚ ਤਾਰਾਂ 'ਤੇ ਚੜ੍ਹਨਾ ਖੰਭਿਆਂ 'ਤੇ ਚੜ੍ਹਨਾ ਰਾਤ ਬਰਾਤੇ ਗਿਲੀਆਂ ਤਾਰਾਂ ਨੂੰ ਹੱਥ ਲਾਉਣਾ ਮੀਂਹ ਕਨੀ 'ਚ ਬਹੁਤ ਔਖਾ ਹੁੰਦਾ ਸਾਰੇ ਕਿਤੇ ਖਤਰਾ ਹੁੰਦਾ ਹੈ ਉਹ ਤਾਂ ਗੈਸ ਸਿਲੰਡਰਾਂ ਵਾਲਿਆਂ ਤਾਂ ਸਿਲੰਡਰ ਏਜੰਸੀਆਂ 'ਚ ਕੰਮ ਕਰਨ ਵਾਲੀ ਲੇਵਰਾਂ ਨੂੰ ਵੀ ਖਤਰਾ ਹੁੰਦਾ ਸਿਲੰਡਰ ਕੋਈ ਲੀਕ ਕਰ ਜੇ ਕਤਰ ਜੇ ਸਭ ਤੋਂ ਜ਼ਿਆਦਾ ਜਾਨ ਨੂੰ ਖਤਰਾ ਹੁੰਦਾ ਲੇਬਰ ਵਾਲਿਆਂ ਨੂੰ ਮਤਲਬ ਕੋਈ ਵੀ ਲੇ ਏ ਕੰਪਨੀ ਹੈ ਕਿ ਕੋਈ ਵੀ ਕਾਰਖਾਨਾ ਹਰੇਕ ਕਾਰਖਾਨੇ ਵਿੱਚ ਲੇਬਰ ਲੇਬਰਾਂ 'ਤੇ ਜਾਨ 'ਤੇ ਬਣੀ ਹੁੰਦੀ ਹੈ ਹਰੇਕ ਨੂੰ ਖਤਰਾ ਹੁੰਦਾ ਹੈ ਕੋਈ ਮਰਜ਼ੀ ਕੱਪੜੇ ਦਾ ਕਾਰਖਾਨਾ ਤਾਂ ਵੀ ਕ ਖਤਰਾ ਕੋਈ ਬਿ ਬਿਜਲੀ ਵਾਲਾ ਕਾਰਖਾਨਾ ਤਾਂ ਵੀ ਖਤਰਾ ਕੋਈ ਮ ਚੀਜ਼ ਬਣਾਉਣ ਦਾ ਕਾਰਖਾਨਾ ਉੱਥੇ ਵੀ ਖਤਰਾ ਹਰ ਥਾਂ 'ਤੇ ਖਤਰਾ ਹੀ ਖਤਰਾ